ਹੈਲੋ ਹਾਂਜੀ ਹਾਂਜੀ ਸਰ ਤੁਸੀਂ ਕੌਣ ਜੀ ਓਕੇ ਸਰ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜੀ ਜਿਵੇਂ ਤੁਸੀਂ ਕਦੋਂ ਆਉਣਾ ਜੀ ਓਕੇ ਜੀ ਠੀਕ ਆ ਜੀ ਅਤੇ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਹੈਲੋ ਹਾਂ ਅਸੀਂ ਸਭ ਤੋਂ ਵੱਧ ਮਸ਼ਹੂਰ ਸਥਾਨ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਸਿੱਖਾਂ ਦਾ ਧਾਰਮਿਕ ਅਸਥਾਨ ਜਿੱਥੇ ਲੋਕ ਆਪਣਾ ਦੂਰੋਂ ਦੂਰੋਂ ਆਉਂਦੇ ਆ ਜੀ ਬਾਹਰ ਦੀਆਂ ਕੰਟਰੀਆਂ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਦਾ ਤੁਹਾਨੂੰ ਜੀ ਅੰਮ੍ਰਿਤਸਰ ਆਪਣਾ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਇਹਦਾ ਇਤਿਹਾਸ ਇਹ ਆ ਜੀ ਇਹਦੇ ਚਾਰ ਦਰਵਾਜੇ ਰੱਖੇ ਹੋਏ ਆ ਜੀ ਇੱਥੇ ਆਪਣੇ ਹਰੇਕ ਧਰਮ ਦੇ ਲੋਕ ਆ ਜਾ ਸਕਦੇ ਐਂ ਜੀ ਅਤੇ ਇੱਥੇ ਆਪਣੇ ਇਹਨਾਂ ਦੀ ਯਾਦ ਵਿੱਚ ਇੱਕ ਸ਼ਹੀਦੀ ਸਾਕਾ ਵੀ ਬਣਿਆ ਹੋਇਆ ਜੀ ਭਗਤ ਸਿੰਘ ਹੋਣਾ ਦੀ ਯਾਦ ਵਿੱਚ ਜਲਿਆਂਵਾਲਾ ਬਾਗ ਅਤੇ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਵੀ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਅਤੇ ਇੱਥੇ ਆਮ ਖਾਸ ਬਾਗ ਆ ਜੀ ਜਿੱਥੇ ਵੀ ਲੋਕ ਦੂਰੋਂ ਦੂਰੋਂ ਘੁੰਮਣ ਆਉਂਦੇ ਆ ਮੁਗਲਾਂ ਦੇ ਟਾਈਮ ਤੋਂ ਬਣਿਆ ਹੋਇਆ ਜੀ ਇਹ ਅਤੇ ਇੱਕ ਇੱਥੇ ਹੋਰ ਜੀ ਆਪਣੀ ਖਾਸ ਇੱਥੇ ਟੋਡਰ ਮੱਲ ਹਵੇਲੀ ਆ ਜੀ ਹਾਂਜੀ ਹਾਂ ਜਿਹਨਾਂ ਨੇ ਮਾਤਾ ਗੁਜਰ ਕੌਰ ਜੀ ਦੇ ਸਸਕਾਰ ਨੂੰ ਜੀ ਮੋਹਰਾਂ ਦੇ ਕੇ ਜਗ੍ਹਾ ਲਈ ਸੀ ਅਤੇ ਇਹਨੂੰ ਜੀ ਸਭ ਤੋਂ ਮਹਿੰਗੀ ਧਰਤੀ ਕਿਹਾ ਜਾਂਦਾ ਜੀ ਇੱਥੇ ਫਤਿਹਗੜ੍ਹ ਸਾਹਿਬ ਜੀ ਅਤੇ ਬਾਕੀ ਇੱਥੋਂ ਦਾ ਕਲਚਰ ਅਸੀਂ ਤੁਹਾਨੂੰ ਦੱਸ ਦਿੰਦੇ ਜੀ ਬਹੁਤ ਮੇਲੇ ਹੁੰਦੇ ਆ ਜੀ ਪੰਜਾਬੀ ਕਲਚਰ ਆ ਜੀ ਬਾਕੀ ਤੁਸੀਂ ਦੱਸ ਦਿਓ ਜੀ ਜਿਵੇਂ ਵੀ ਤੁਹਾਨੂੰ ਠੀਕ ਲੱਗਿਆ ਜੀ ਠੀਕ ਆ ਜੀ ਸਰ ਓਕੇ